ਦੇਖੋ ਜੀ ਪਸ਼ੂ ਪਾਲਣ ਇੱਕ ਬਹੁਤ ਹੀ ਵਧੀਆ ਕਿੱਤਾ ਜੀ ਜਿਹਦੇ ਨਾਲ ਪਸ਼ੂ ਪਾਲਣ 'ਚ ਬਹੁਤ ਹੀ ਵਧੀਆ ਕੰਮ ਹੈ ਪਸ਼ੂ ਜਿਹਦੇ ਨਾਲ ਦੁੱਧ ਵੀ ਮਿਲਦਾ ਜੀ ਅਤੇ ਪਸ਼ੂ ਦੀ ਪੂਰੀ ਸਫਾਈ ਵੀ ਰੱਖਣੀ ਪੈਂਦੀ ਆ ਅਤੇ ਪਹਿਲੇ ਇੰਨੀ ਸਫਾਈ ਨਹੀਂ ਹੁੰਦੀ ਸੀ ਹੁਣ ਲੋਕਾਂ ਨੇ ਸ਼ੈੱਡਾਂ ਲਾ ਲਈਆਂ ਸ਼ੈੱਡਾਂ ਪਾ ਲਈਆਂ ਬਹੁਤ ਵਧੀਆ ਤਰੀਕੇ ਨਾਲ ਚਲਦੇ ਪਹਿਲੇ ਲੋਕਾਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ ਸੀ ਪਹਿਲੇ ਹੁਣ ਕਾਫੀ ਸਹੂਲਤਾਂ ਹੋ ਗਈਆਂ ਡਾਕਟਰ ਨੂੰ ਵੀ ਦਿਖਾ ਲਈ ਦਾ ਜਿਸ ਤਰ੍ਹਾਂ ਵੀ ਡਾਕਟਰ ਕਹਿਣ ਉਸ ਤਰ੍ਹਾਂ ਚੱਲੀ ਦਾ ਚਾਰਾ ਵੀ ਬਹੁਤ ਸਹੀ ਢੰਗ ਨਾਲ ਚੱਲੀ ਦਾ ਜੇਕਰ ਵਿੱਚੋਂ ਬਹੁਤ ਹੀ ਸਰਕਾਰ ਵੱਲੋਂ ਵੀ ਬਹੁਤ ਸਹੂਲਤਾਂ ਮਿਲਦੀਆਂ ਜੀ ਜੇ ਵਿੱਚੋਂ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਜਾਨਵਰ ਵੀ ਠੀਕ ਰਹਿੰਦਾ ਹੈ ਇੱਕ ਪਿੱਛੇ ਹੀ ਇੱਕ ਕੁੱਤਾ ਬਿਮਾਰ ਹੋ ਗਿਆ ਜਿਹਦੇ ਵਿੱਚ ਮੈਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਪਿਆ ਇਸ ਵੇਲੇ ਸੰਸਥਾਵਾਂ ਬੜੀਆਂ ਚੱਲ ਪਈਆਂ ਜੀ ਫੋਨ ਕਰੋ ਆ ਜਾਂਦੇ ਨੇ ਪਹਿਲੇ ਨਾਲੋਂ ਹੁਣ ਅੱਜ ਦਾ ਸਮਾਂ ਬਹੁਤ ਹੀ ਵਧੀਆ ਵਧੀਆ ਖੁਰਾਕਾਂ ਮਿਲ ਰਹੀਆਂ ਪਸੂਆਂ ਨੂੰ ਸਭ ਠੀਕ ਮਿਲ ਰਿਹਾ ਲੇਕਿਨ ਸਹੀ ਪ੍ਰੋਗਰਾਮ ਚੱਲ ਰਿਹਾ ਜੀ